ਮੇਰੀ ਸਭ ਤੋਂ ਸੋਹਣੀ ਯਾਤਰਾ ਸੀ ਚੰਡੀਗੜ੍ਹ ਦੀ ਜੋ ਕਿ ਮੈਂ ਆਪਣੇ ਘਰਦਿਆਂ ਨਾਲ ਕੀਤੀ ਜਿਵੇਂ ਮੇਰੇ ਮੱਮਾ ਪਾਪਾ ਸਾਰੇ ਗਏ ਸੀ ਉੱਥੇ ਉੱਥੇ ਜਾ ਕੇ ਅਸੀਂ ਬਹੁਤ ਫਨ ਕੀਤਾ ਇੰਜੋਏ ਕੀਤਾ ਜਿਹਦੇ ਨਾਲ ਕਿ ਅਸੀਂ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਦੇਖੀਆਂ ਜਿਵੇਂ ਕਿ ਅਸੀਂ ਉੱਥੇ ਸੁਬਹ ਉੱਠਦੇ ਸਾਰ ਹੀ ਪਹਿਲਾਂ ਮੌਲ ਦੇਖਣ ਗਏ ਮੌਲ ਵਿੱਚ ਮੌਲ ਜੋ ਕਿ ਬਹੁਤ ਵੱਡਾ ਸੀ ਅਲਾਂਟੇ ਮੌਲ ਤਾਂ ਉੱਥੇ ਬਹੁਤ ਸਾਰੀਆਂ ਸ਼ੋਪਸ ਸੀਗੀਆਂ ਜਿੱਥੋਂ ਅਸੀਂ ਸ਼ੋਪਿੰਗ ਕੀਤੀ ਬਹੁਤ ਸਾਰੇ ਸਮਾਨ ਖਰੀਦੇ ਜਿਵੇਂ ਕੱਪੜੇ ਸ਼ੂਜ ਇਹ ਸਾਰਾ ਕੁਝ ਅਸੀਂ ਖਰੀਦਿਆ ਦੈਨ ਫਿਰ ਅਸੀਂ ਗਏ ਸੁਖਨਾ ਲੇਕ ਜੋ ਕਿ ਉੱਥੇ ਬਹੁਤ ਸੋਹਣੀ ਸੀ ਅਸੀਂ ਉੱਥੇ ਸੂ ਸੂਰਜ ਨੂੰ ਡੁੱਬਦੇ ਹੋਏ ਦੇਖਿਆ ਜੋ ਕਿ ਬਹੁਤ ਸੋਹਣਾ ਲੱਗ ਰਿਹਾ ਸੀ ਕਿਉਂਕਿ ਉੱਥੇ ਲੇਕ 'ਤੇ ਪਾਣੀ ਸੀ ਜੋ ਕਿ ਰਾਤ ਨੂੰ ਬਹੁਤ ਸੋਹਣਾ ਲੱਗਦਾ ਸੀ ਉੱਥੇ ਦੀ ਲ ਲਾਈਟਾਂ ਜੋ ਕਿ ਬਹੁਤ ਸੋਹਣੀਆਂ ਸੀ ਉਸ ਤੋਂ ਬਾਅਦ ਅਸੀਂ ਵਾਪਸੀ ਗਏ ਛੱਤ ਬੀੜ ਜ਼ੂ ਜੋ ਕਿ ਜ਼ੂ ਬਹੁਤ ਸੋਹਣਾ ਸੀ ਅਗਲੇ ਦਿਨ ਫਿਰ ਅਸੀਂ ਜੂ ਗਏ ਸੀ ਪਹਿਲਾਂ ਨਹੀਂ ਅਗਲੇ ਦਿਨ ਅਸੀਂ ਜ਼ੂ ਗਏ ਜੋ ਜ਼ੂ ਵਿੱਚ ਬਹੁਤ ਸਾਰੇ ਜਾਨਵਰ ਪੰਛੀ ਸੀ ਜੋ ਬਹੁਤ ਵੱਡੇ ਵੱਡੇ ਸੀ ਜਿਹਨਾਂ ਦੀਆਂ ਅਸੀਂ ਤਸਵੀਰਾਂ ਲਈਆਂ ਤਾਂ ਉਹ ਬਹੁਤ ਸੋਹਣਾ ਦ੍ਰਿਸ਼ ਸੀ ਅਤੇ ਫਿਰ ਵਾਪਸੀ ਅਸੀਂ ਘਰ ਆਉਂਦੇ ਹੋਏ ਹੋਰ ਜਗ੍ਹਾ 'ਤੇ ਗਏ ਜਿਵੇਂ ਪਟਿਆਲਾ ਕਾਲੀ ਮਾਤਾ ਦਾ ਮੰਦਰ ਉਹ ਵੀ ਉੱਥੇ ਬਹੁਤ ਵਧੀਆ ਬਣਿਆ ਹੋਇਆ ਸੀ ਜਿਹਦੇ ਨਾਲ ਕਿ ਸਾਨੂੰ ਬਹੁਤ ਤਸੱਲੀ ਹੋਈ ਕਿ ਅਸੀਂ ਸਹੀ ਸਹੀ ਯਾਤਰਾ ਕੀਤੀ ਹੈ ਅਤੇ ਮੇਰੇ ਲਈ ਇਹ ਸਭ ਤੋਂ ਯਾਤਰਾ ਵਧੀਆ ਤਾਂ ਸੀ ਕਿਉਂਕਿ ਇਹਦੇ ਵਿੱਚ ਮੇਰੇ ਮੱਮਾ ਪਾਪਾ ਮੇਰੇ ਨਾਲ ਸੀ ਮੇਰੀ ਸਾਰੀ ਫੈਮਿਲੀ ਨਾਲ ਸੀ